ਸਤਿ ਸ਼੍ਰੀ ਅਕਾਲ ਮੈਂ ਕੈਬ ਬੁੱਕ ਕਰਵਾਈ ਹੈ ਮੈਨੂੰ ਉਡੀਕਦਿਆਂ ਕਾਫ਼ੀ ਸਮਾਂ ਹੋ ਗਿਆ ਤੁਹਾਡਾ ਡਰਾਈਵਰ ਦਾ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਪਰ ਛੇਤੀ ਤੋਂ ਛੇਤੀ ਮੇਰੇ ਕੋਲ਼ ਭੇਜਿਆ ਜਾਵੇ ਮੈਂ ਅੰਬਰਸਰ ਪਹੁੰਚਣਾ ਹੈ ਧੰਨਵਾਦ